ਮੇਰੀ ਮਨਪਸੰਦ ਕਿਤਾਬ ਸਾਡਾ ਦੇਸ਼ ਹੈ ਇਸ ਦਾ ਲੇਖਕ ਮਨੀਸ਼ ਜਿੰਦਲ ਹੈ ਇਹ ਕਿਤਾਬ ਮੈਨੂੰ ਬਹੁਤ ਹੀ ਪਸੰਦ ਆਈ ਮੈਂ ਆਪਣੇ ਦੋਸਤਾਂ ਤੋਂ ਪੁੱਛਿਆ ਕਿ ਮੈਂ ਪੰਜਾਬ ਦੀ ਰਹਿਣ ਵਾਲੀ ਹੋਣ ਕਰਕੇ ਕਿਹੜੀ ਬੁੱਕ ਅ ਕਿਹੜੀ ਕਿਤਾਬ ਪੜ੍ਹਾਂ ਮੇਰੇ ਦੋਸਤਾਂ ਨੇ ਮੈਨੂੰ ਦੱਸਿਆ ਕਿ ਸਾਡਾ ਦੇਸ਼ ਏ ਸਾਡਾ ਪੰਜਾਬ ਬਹੁਤ ਹੀ ਵਧੀਆ ਏ ਏ ਕਿਤਾਬ ਹੈ ਅਤੇ ਮੈਂ ਉਹਨਾਂ ਦੇ ਕਹਿਣ 'ਤੇ ਇਹ ਬੁੱਕ ਖ਼ਰੀਦੀ ਅਤੇ ਮੈਂ ਇਸ ਬੁੱਕ ਵਿੱਚ ਸਾਰਾ ਪੰਜਾਬ ਬਾਰੇ ਵੇਖਿਆ ਇਸ ਵਿੱਚ ਪੰਜਾਬ ਦੇ ਮੇਲੇ ਤਿਉਹਾਰ ਸੱਭਿਆਚਾਰ ਜਿਹ ਜਿਹੜੇ ਵੀਰ ਜਿਹਨਾਂ ਨੇ ਸਾਡੇ ਲਈ ਅਜ਼ਾਦੀ ਦਿੱਤੀ ਸਾਡੇ ਦੇਸ਼ ਨੂੰ ਅੰਗ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਇਆ ਅਜਿਹੀਆਂ ਮਹਾਨ ਸ਼ਖਸ਼ੀਅਤਾਂ ਸਨ ਅਤੇ ਇਸ ਵਿੱਚ ਬਹੁ ਸਾ ਪੰਜਾਬ ਵਿੱਚ ਸੱਭਿਆਚਾਰ ਜੋ ਵੀ ਹੈਗਾ ਉਸ ਇਸ ਵਿੱਚ ਇਹ ਵੀ ਜਾਣਕਾਰੀ ਦੇਖਣ ਨੂੰ ਮਿਲੀ ਸਾਡਾ ਪੰਜਾਬ ਪੰਜਾਬ ਕਿਤਾਬ ਬਹੁਤ ਹੀ ਵਧੀਆ ਹੈ ਇਸ ਵਿੱਚ ਬਹੁਤ ਹੀ ਜ਼ਿਆਦਾ ਅ ਡੂੰਘੀਆਂ ਗੱਲਾਂ ਬਾਰੇ ਮੈਨੂੰ ਜਾਣਕਾਰੀ ਮਿਲੀ ਇਹ ਕਿਤਾਬ ਮੈਨੂੰ ਬਹੁਤ ਹੀ ਪਸੰਦ ਆਈ ਇਸ ਵਿੱਚ ਸਾਰਾ ਸਾਰੀ ਸਾਰਾ ਇਤਿਹਾਸ ਭੂਗੋਲ ਦੱਸਿਆ ਗਿਆ ਸੀ ਜਿਸ ਕਰਕੇ ਮੈਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ